ਟੈਕਨੋਲੋਜੀ ਆਉਣ ਨਾਲ ਸਾਡਾ ਜੀਵਨ ਪੱਧਰ ਜੀਵਨ ਬਦਲ ਗਿਆ ਹੈ ਜ਼ਿੰਦਗੀ ਬਦਲ ਗਈ ਹੈ ਪਰ ਬਿਮਾਰੀਆਂ ਬਹੁਤ ਤਰ੍ਹਾਂ ਦੀਆਂ ਲੱਗ ਗਈਆਂ ਹਨ ਪਹਿਲਾਂ ਖੁਰਾਕਾਂ ਵੀ ਵਧੀਆ ਸਨ ਅਤੇ ਨਾ ਹੀ ਕਿਸੇ ਨੂੰ ਕੋਈ ਬਿਮਾਰੀ ਸੀ ਜਿਵੇਂ ਅੱਜ ਦੇ ਅੱਜ ਦੇ ਟਾਈਮ ਦੀ ਗੱਲ ਕਰੀਏ ਖੁਰਾਕਾਂ ਜਿੱਦਾਂ ਦੀਆਂ ਖੁਰਾਕਾਂ ਹਨ ਉੱਦਾਂ ਦੀਆਂ ਬਿਮਾਰੀਆਂ ਹਨ ਨਵੇਂ ਨਵੇਂ ਢੰਗ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ